ਹੈਲੋ ਹੈਲੋ ਸਰ ਮੈਂ ਹੁਸ਼ਿਆਰਪੁਰ ਘੁੰਮਣ ਆਈ ਐਂ ਅਤੇ ਮੈਂ ਪੁੱਛਣ ਚਾਹੁੰਦੀ ਹੈਗੀ ਕਿੱਥੇ ਕਿੱਥੇ ਘੁੰਮਣ ਜਾਵਾਂ ਅਤੇ ਮੈਂ ਪੰਦਰ੍ਹਾਂ ਦਿਨ ਵਾਸਤੇ ਆਈ ਮੈਂ ਆ ਗਏ ਆ ਗਏ ਮਹਾਰਾਜਾ ਹੋਟਲ 'ਚ ਰੁਕਿਆ ਅਤੇ ਮੈਂ ਪੁੱਛਣਾ ਹਾਂ ਕਿੱਥੇ ਕਿੱਥੇ ਜਾਈਏ ਅਤੇ ਕਿਹੜੇ ਕਿਹੜੇ ਰੈਸਟੋਰੈਂਟ ਤਿੰਨ ਬੰਦੇ ਹੈਗੇ ਅਸੀਂ ਤਿੰਨ ਬੰਦੇ ਹਾਂਜੀ ਹਾਂਜੀ ਹਾਂਜੀ ਵੈਜੀਟੇਰੀਅਨ ਵੈਜੀਟੇਰੀਅਨ ਹਾਂਜੀ ਹਾਂਜੀ ਕਿਹੜੀ ਕਿਹੜੀ ਲੱਸੀ ਵਾਲਾ ਹਾਂਜੀ ਕਿੰਨੀ ਦੂਰ ਹੈ ਜੀ ਦੂਰ ਨਹੀਂ ਆਪਣੀ ਵਹੀਕਲਸ ਆਪਣੀ ਵਹੀਕਲ ਹੈ ਹਾਂਜੀ ਹਾਂਜੀ ਅੱਛਾ ਅੱਛਾ

ਅੱਛਾ ਜੀ ਕਿੰਨੀ ਦੂਰ ਹੈਗਾ ਦੂਰ ਕਿੰਨੀ ਹੈਗਾ ਦੂਰ ਵਗੈਰਾ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਅੱਛਾ ਜੀ ਅੱਛਾ ਅੱਛਾ ਅੱਛਾ ਅੱਛਾ ਅੱਛਾ ਜੀ ਅੱਛਾ ਅੱਛਾ ਅੱਛਾ ਅੱਛਾ ਪ੍ਰਾਈਜ ਵਗੈਰਾ ਪ੍ਰਾਈਜ ਵਗੈਰਾ ਪ੍ਰਾਈਜ ਵਗੈਰਾ ਠੀਕ ਹੈਗੇ ਨਾ ਪ੍ਰਾਈਜ਼ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਜੀ ਅੱਛਾ ਜੀ

ਅੱਛਾ ਜੀ ਠੀਕ ਅੱਛਾ ਉਹ ਕਿੱਥੇ ਉਹ ਅੱਛਾ ਅੱਛਾ ਅੱਛਾ ਜੀ ਅੱਛਾ ਅੱਛਾ ਅੱਛਾ ਅੱਛਾ ਹੋਰ ਕਿਹੜੀ ਜਗ੍ਹਾ ਘੁੰਮਣ ਹਾਂਜੀ ਓ ਅੱਛਾ ਅੱਛਾ ਹੋਰ ਕੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ

ਅੱਛਾ ਜੀ ਦਸ ਦਸ ਪੰਦਰ੍ਹਾਂ ਦਿਨ ਵਾਸਤੇ ਹੈਗੇ ਇੱਧਰ ਹੈਗੇ

ਅੱਛਾ ਅੱਛਾ ਜੀ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਜੀ ਅੱਛਾ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਜੀ ਬਾਏ ਜੀ ਬਾਏ ਬਾਏ ਜੀ ਬਾਏ ਬਾਏ